ਹੈਲੋ ਸ਼ੱਸ਼ੀਕਾਲ ਜੀ ਹਾਂਜੀ ਹਾਂਜੀ ਹਾਂਜੀ ਕਾਹਦੀ ਕੋਚਿੰਗ ਲੈਣੀ ਆ ਤੁਸੀਂ

ਹਾਂਜੀ ਤੁਸੀਂ ਆਪ ਲੈਣੀ ਸੀ ਜਾਂ ਤੁਹਾਡੇ ਫੈਮਲੀ ਮੈਂਬਰ ਚੋਂ ਕਿਸੇ ਨੇ ਹਾਂਜੀ ਕੋਈ ਗੱਲ ਨੀ ਤੁਹਾਨੂੰ ਅਸੀਂ ਵਧੀਆ ਕੋਚਿੰਗ ਦਿਆਂਗੇ ਸਾਡੇ ਕੋਲ ਬਹੁਤ ਸਾਰੇ ਟ੍ਰੇਨਿੰਗ ਹੈਗੇ ਆ ਤੇ ਤੁਹਾਨੂੰ ਇੱਕ ਫੀਮੇਲ ਟ੍ਰੇਨਰ ਹੀ ਦਿੱਤਾ ਜਾਏਗਾ ਜੋ ਤੁਹਾਨੂੰ ਬਹੁਤ ਵਧੀਆ ਟ੍ਰੇਨਿੰਗ ਦਏਗਾ ਹਾਂਜੀ ਤੁਹਾਨੂੰ ਪੈਕ ਲੈਣੇ ਪਏਗਾ ਕੋਈ ਨਾ ਕੋਈ ਸਾਡੇ ਅਲੱਗ ਅਲੱਗ ਪੈਕ ਵੀ ਹ ਇੱਕ ਗੈਰ ਥ੍ਰੀ ਮੰਥ ਦਾ ਪੈ ਟੈਂਨ ਥਾਊਜੈਂਟ ਫੀਸ ਹੈ ਜੀ ਇਹਦੀ ਇੱਕ ਕੇ ਟੂ ਥਾਊਜੈਂਟ ਦਾ ਜਿਨਦੀ ਏਟ ਥਾਊਜੈਂਟ ਫੀਸ ਹੈਗੀ ਐ ਟੂ ਏਟਹ ਮਤਲਬ ਟੂ ਮੰਨਥ ਦਾ ਹਾਂਜੀ ਟਾਈਮਿੰਗ ਮੋਰਨਿੰਗ ਹੋਏਗੀ ਨਾਈਨ ਏ ਐਮ ਟੂ ਟਵੈਲਵ ਪੀ ਐੱਮ ਹੋਰ ਹੋਏਗੀ ਈਵਨਿੰਗ ਦੀ ਫੋਰ ਪੀ ਐਮ ਟੂ ਏਟ ਪੀ ਐਮ ਹਾਂਜੀ ਹਾਂਜੀ ਤੁਸੀਂ ਕਿਹੜਾ ਸਲੋਟ ਲੈਣਾ ਚਾਹੋਗੇ ਹਾਂਜੀ ਤੁਹਾਨੂੰ ਪ੍ਰੋਵਾਈਡ ਕਰਾਂਗੇ ਹਾਂਜੀ ਤੁਸੀਂ ਦੱਸ ਹਾਂਜੀ ਤੁਸੀਂ ਅਸੀਂ ਤੁਹਾਨੂੰ ਕੁਛ ਨਾ ਕੁਛ ਲੈਸ ਜਰੂਰ ਕਰਾਂਗੇ ਤੁਸੀਂ ਸਾਨੂੰ ਇੱਕ ਵਾਰ ਦੱਸ ਦੋ ਕਿ ਤੁਸੀਂ ਕਿਹੜਾ ਪੈਕ ਲੈਣਾ ਚਾਹੁੰਦੇ ਹੋ ਹਾਂਜੀ ਟੂ ਏਟ ਥਾਊਜੈਂਟ ਫੀਸ ਹਾਂਜੀ ਤੁਹਾਨੂੰ ਹੰਡਰਡ ਪ੍ਰਸੈਂਟ ਮਿਲੇਗਾ ਪੂਰਾ ਕਿਉਂਕਿ ਸਾਡੇ ਕੋਲ ਬਹੁਤ ਵਧੀਆ ਵਧੀਆ ਕੋਚ ਐ ਜੋ ਬਾਹਰ ਤੋਂ ਟ੍ਰੇਨਿੰਗ ਲੈ ਕੇ ਆਏ ਹੋਏ ਐ ਤੁਹਾਨੂੰ ਬਹੁਤ ਵਧੀਆ ਟ੍ਰੇਨਿੰਗ ਮਿਲੇਗੀ ਹਾਂਜੀ ਕਲਾਸਿਜ ਵੀ ਦਿਆਂਗੇ ਹਾਂਜੀ ਹਾਂਜੀ ਨਹੀਂ ਜੀ ਮੈਥ ਨੀ ਕਰਵਾਉਂਦੇ ਅਸੀਂ ਤੁਹਾਨੂੰ ਸਿਰਫ ਟ੍ਰੇਨਿੰਗ ਦਿਆਂਗੇ ਹਾਂਜੀ ਹਾਂਜੀ ਭਾਅ ਜੀ ਇਹ ਤੁਹਾਡੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਟੂ ਮੰਥ ਵਾਲਾ ਲੈਣਾ ਜਿਨਦੀ ਏਟ ਥਾਊਜੈਂਟ ਫੀਸ ਮੈਂ ਤੁਹਾਨੂੰ ਦੱਸੀ ਉਹਦੇ ਵਿੱਚ ਅਸੀਂ ਤੁਹਾਨੂੰ ਕੁਝ ਲੈਸ ਕਰਦਾਂਗੇ ਮਤਲਬ ਸੈਵਨ ਸਟੂਡੈਂਟ ਨੇ ਤੁਹਾਨੂੰ ਫੀਸ ਦੇਣੀ ਪਏਗੀ ਹਾਂਜੀ ਹਾਂਜੀ ਟ੍ਰੇਨਿੰਗ ਤੋਂ ਬਾਅਦ ਤੁਸੀਂ ਅੱਗੇ ਤਾਂ ਤੁਹਾਡੀ ਮਰਜੀ ਐ ਤੁਸੀਂ ਕੀ ਕਰਨਾ ਚਾਹੁੰਦੇ ਹੋ ਹਾਂਜੀ ਹਾਂਜੀ ਉਹ ਤਾਂ ਤੁਹਾਨੂੰ ਸਰਟੀਫਿਕੇਟ ਦਿੱਤਾ ਜਾਏਗਾ ਜਿਵੇਂ ਟੂ ਮੰਥ ਦੀ ਤੁਹਾਡੀ ਟਰੇਨਿੰਗ ਹੋਏਗੀ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਸਰਟੀਫਿਕੇਟ ਦਿੱਤਾ ਜਾਏਗਾ ਹਾਂਜੀ ਹਾਂਜੀ ਨਾਲ ਦੀ ਨਾਲ ਮਿਲਜੇਗਾ ਹਾਂਜੀ ਪਹਿਲੀ ਗੱਲ ਤਾਂ ਕੀ ਤੁਹਾਨੂੰ ਹੰਡਰਡ ਪ੍ਰਸੈਂਟ ਤੁਹਾਡੇ 'ਚ ਸੁਧਾਰ ਆਏਗਾ ਅਗਰ ਨਹੀਂ ਵੀ ਆਉਂਦਾ ਤੁਸੀਂ ਜਵਾਬ ਹੋ